ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਠੀਕ ਹਾਂ ਜੀ ਤੁਸੀਂ ਦੱਸੋ ਹਾਂਜੀ ਦੱਸੋ ਜੀ ਹਾਂਜੀ ਮੈਮ ਸ਼ਰਮਾ ਸਵੀਟਸ ਹੈ ਜੋ ਸਾਡੀ ਫੈਮਿਲੀ ਦੀ ਸ਼ੌਪ ਹੈ ਸਨੇਟੇ ਅੱਛੀ ਬਹੁਤ ਅੱਛੀ ਮਿਠਾਈ ਬਣਾਉਂਦੇ ਆ ਪਿਓਰ ਤੁਸੀਂ ਉੱਥੇ ਜਾ ਸਕਦੇ ਹੋ ਉਸ ਤੋਂ ਇਲਾਵਾ ਗੋਪਾਲ ਸਵੀਟਸ ਹੈ ਔਰ ਚੰਡੀਗੜ੍ਹ ਸਵੀਟਸ ਜੋ ਖਰੜ ਦੇ ਰਸਤੇ 'ਚ ਪੈ ਜਾਂਦਾ ਇੱਕ ਉਹਨਾਂ ਕੋਲ ਵੀ ਅੱਛੀ ਸਵੀਟਸ ਹੁੰਦੀਆਂ ਸਪੈਸ਼ਲ ਉਹਨਾਂ ਦੀ ਬਰਫ਼ੀ ਹੈ ਜੀ ਖੋਏ ਦੀ ਬਰਫ਼ੀ ਲਗਾ ਲਓ ਜਿਸ ਤਰ੍ਹਾਂ ਔਰ ਬੇਸਣ ਦੀ ਬਰਫ਼ੀ ਮਤਲਬ ਕਾਫ਼ੀ ਆਈਟਮਜ਼ ਹੁੰਦੀਆਂ ਮਿਠਾਈ 'ਚ ਓਂ ਤੁਸੀਂ ਜੋ ਲੈਣਾ ਚਾਹੁੰਦੇ ਹੋ ਜਾ ਕੇ ਦੇਖ ਲਿਓ ਤੁਹਾਡੀ ਚੋਇਸ ਦੇ ਅਕੋਡਿੰਗ ਲੈ ਲਿਓ ਤੁਸੀਂ ਪ੍ਰਾਈਜ਼ ਹਾਂਜੀ ਜੇ ਜ਼ਿਆਦਾ ਲੈਣੀ ਹੈ ਪਾਰਟੀ ਵਾਸਤੇ ਲੈਣੀ ਆ ਤਾਂ ਫਿਰ ਉਹ ਤਾਂ ਡਿਸਕਾਊਂਟ ਕਰਨਗੇ ਹਾਂ ਜੇ ਮਤਲਬ ਇੱਕ ਦੋ ਪੀਸ ਮਤਲਬ ਇੱਕ ਦੋ ਡੱਬੇ ਲੈਣੇ ਜਾਂ ਕਿੱਲੋ ਦੇ ਹਿਸਾਬ ਨਾਲ ਤਾਂ ਉਹ ਉਸ ਤਰ੍ਹਾਂ ਲੱਗੇਗਾ ਰੇਟ ਫਿਰ ਅਲੱਗ ਅਲੱਗ ਤਰ੍ਹਾਂ ਦਾ ਰੇਟ ਹੁੰਦਾ ਨਾ ਜਿਸ ਤਰ੍ਹਾਂ ਲੈਂਦੇ ਆ ਗੋਪਾਲ ਸਵੀਟਸ ਦੀ ਮਿਠਾਈ ਵੀ ਬਹੁਤ ਅੱਛੀ ਹੁੰਦੀ ਹੈ ਬੱਟ ਉਹ ਬਹੁਤ ਮਹਿੰਗੀ ਹੁੰਦੀ ਆ ਬੱਟ ਹੁੰਦੀ ਬਹੁਤ ਅੱਛੀ ਹੈ ਟੇਸਟੀ ਹੁੰਦੀ ਹੈ ਪਿਓਰ ਹੁੰਦੀ ਹੈ ਖੋਏ ਦੀ ਬਰਫ਼ੀ ਇਸ ਟਾਇਮ ਤਾਂ ਮੈਨੂੰ ਲੱਗਦਾ ਸਾਢੇ ਤਿੰਨ ਸੌ ਰੁਪਈਆ ਰੇਟ ਚੱਲ ਰਿਹਾ ਉਹ ਤਾਂ ਅੱਠ ਸੌ ਰੁਪਏ ਦੇ ਅਕੋਡਿੰਗ ਚੱਲ ਰਹੀ ਹੈ ਬਾਕੀ ਤੁਸੀਂ ਖੁਦ ਪਤਾ ਕਰ ਲਉ ਨਾ ਮੈਨੂੰ ਵੀ ਇੰਨਾਂ ਜ਼ਿਆਦਾ ਨਹੀਂ ਪਤਾ ਨਾ ਨੇੜੇ ਤਾਂ ਸ਼ਰਮਾ ਸਵੀਟਸ ਪੈ ਰਹੀ ਆ ਜਾਂ ਚੰਡੀਗੜ੍ਹ ਸਵੀਟਸ ਪੈ ਰਹੀ ਆ ਆਪਾਂ ਨੂੰ ਸ਼ਰਮਾ ਸਵੀਟਸ ਸਨੇਟਾ ਔਰ ਚੰਡੀਗੜ੍ਹ ਸਵੀਟ ਜਦ ਆਪਾਂ ਖਰੜ ਨੂੰ ਜਾਂਦੇ ਹਾਂ ਤਾਂ ਰਸਤੇ 'ਚ ਹੀ ਆ ਜਾਂਦੀ ਆ ਲੱਡੂ ਗੋਪਾਲ ਸਵੀਟਸ ਔਰ ਚ ਚੰਡੀਗੜ੍ਹ ਸਵੀਟਸ ਇੱਕ ਦੂਸਰੇ ਦੇ ਆਹਮਣੇ ਸਾਹਮਣੇ ਪੈ ਜਾਂਦੀਆਂ

ਓਕੇ ਜੀ